ਹਾਂ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਫਲਿਪ ਕਾਰਟ ਤੋਂ ਇੱਕ ਆਪਣੇ ਸ਼ੂਜ ਫਸਟ ਟਾਈਮ ਜੋ ਆਰਡਰ ਕੀਤੇ ਸੀਗੇ ਪਹਿਲੀ ਵਾਰ ਜਿਵੇਂ ਆਰਡਰ ਕੀਤੇ ਸੀ ਆਪਣੇ ਸ਼ੂਜ ਰੈਟੇਪ ਦੇ ਅੱਜ ਤੋਂ ਤਕਰੀਬਨ ਤਕਰੀਬਨ ਤਿੰਨ ਸਾਲ ਪਹਿਲਾਂ ਅਤੇ ਉਹ ਬੂਟ ਜੋ ਵੀ ਮੈਂ ਮਤਲਬ ਸਪੈਸੀਫਿਕੇਸ਼ਨ ਜੋ ਵਿਸ਼ੇਸ਼ਤਾਵਾਂ ਉਸ ਪ੍ਰੋਡਕਟ ਦੀਆਂ ਮੈਂ ਦੇਖੀਆ ਸੀਗੀਆਂ ਆਨਲਾਈਨ ਉਹ ਸਭ ਮਤਲਬ ਸਾਰੀਆਂ ਉਸ ਪ੍ਰੋਡਕਟ ਦੇ ਵਿੱਚ ਉਚਿਤ ਸੀ ਜਦੋਂ ਮੈਂ ਉਹ ਪ੍ਰੋਡਕਟ ਨੂੰ ਰਿਸੀਵ ਕੀਤਾ ਜਦੋਂ ਉਹ ਪ੍ਰੋਡਕਟ ਮੈਨੂੰ ਮਿਲਿਆ ਅਤੇ ਇਹ ਉਹ ਉਸਦਾ ਸਾਈਜ਼ ਵੀ ਮਤਲਬ ਜੋ ਮੈਂ ਉੱਥੇ ਆਰਡਰ ਕੀਤਾ ਸੀ ਓਹੀ ਓ ਸੀ ਕਲਰ ਵਗੈਰਾ ਵੀ ਓਹੀਓ ਸੀ ਬ੍ਰਾਂਡ ਜੋ ਸੀ ਉਹ ਵੀ ਸੇਮ ਸੀ ਅਤੇ ਬਹੁਤ ਵਧੀਆ ਮੈਨੂੰ ਉਸ ਦਾ ਜੋ ਹੈ ਜਿਵੇਂ ਆਰਡਰ ਕੀਤਾ ਸੀ ਮੀਨਸ ਫਸਟ ਟਾਈਮ ਔਡਰ ਕੀਤਾ ਫਸਟ ਟਾਈਮ ਐਕਸਪੀਰੀਅਸ ਮੇਰਾ ਬੜਾ ਵਧੀਆ ਰਿਹਾ ਉਲਟਾ ਉਹਨਾਂ ਨੇ ਜੋ ਮੈਨੂੰ ਜਦੋਂ ਮੈਂ ਆਰਡਰ ਕਰ ਰਿਹਾ ਸੀ ਉਹਨਾਂ ਨੇ ਮੈਨੂੰ ਕਾਫੀ ਜੋ ਹੈ ਆਫਰ ਵਗੈਰਾ ਵੀ ਦਿੱਤੇ ਜਿਸ ਵਿੱਚ ਜਿਵੇਂ ਕਿ ਐਚ ਡੀ ਐਫ ਸੀ ਜੋ ਕ੍ਰੈਡਿਟ ਬੈਂਕ ਸੀਗਾ ਉਸ 'ਤੇ ਪੰਜ ਪ੍ਰਸੈਂਟ ਇਂਸਟੈਂਟ ਡਿਸਕਾਊਂਟ ਵੀ ਦਿੱਤਾ ਸੀਗਾ ਅਤੇ ਉਸ ਤੋਂ ਇਲਾਵਾ ਉਹ ਅਲੱਗ ਤੋਂ ਕਰੈਡਿਟ ਕਾਰਡ 'ਤੇ ਵੀ ਦਸ ਪ੍ਰਸੈਂਟ ਓਫਰ ਦੇ ਰਹੇ ਸੀ ਅਤੇ ਕਰੈਡਿਟ ਕਾਰਡ ਜੋ ਮੇਰੇ ਕੋਲ ਤਾਂ ਨਹੀਂ ਸੀ ਬਟ ਮੈਂ ਆਪਣੇ ਕਿਸੇ ਮਿੱਤਰ ਤੋਂ ਲੈ ਕੇ ਉਸ ਕ੍ਰੈਡਿਟ ਕਾਰਡ ਥਰੂ ਜੋ ਅਸੀਂ ਉਹ ਆਰਡਰ ਕੀਤੇ ਜਿਸ 'ਚ ਦਸ ਪ੍ਰਸੈਂਟ ਇੰਸਟੈਂਟ ਡਿਸਕਾਊਂਟ ਮਿਲਿਆ ਔਰ ਉਹਨਾਂ ਨੇ ਉਸਦੀਆਂ ਜੋ ਕਿ ਕਿਸ਼ਤਾਂ ਵੀ ਬਣਾ ਦਿੱਤੀਆਂ ਸੀ ਉਹ ਜੋ ਪੈਸਾ ਸੀ ਮੈਂ ਉਹ ਇੰਸਟਾਲਮੈਂਟ ਦੇ ਵਿੱਚ ਦਿੱਤਾ ਅਤੇ ਉਹ ਜੋ ਬੂਟ ਸੀ ਮੇਰੇ ਲਗਭਗ ਲਗਭਗ ਸਾਲ ਵਧੀਆ ਚੱਲੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਫੀਡਬੈਕ ਵੀ ਮੈਥੋਂ ਲਿਆ ਸੀ ਮੈਂ ਬਹੁਤ ਅੱਛਾ ਉਹਨਾਂ ਦਾ ਉਹਨਾਂ ਨੂੰ ਥੈਂਕਸ ਵੀ ਕੀਤਾ ਕੀ ਬਹੁਤ ਵਧੀਆ ਪ੍ਰੋਡਕਟ ਤੁਸੀਂ ਜੋ ਹੈ ਪ੍ਰੋਵਾਈਡ ਕੀਤਾ ਜੋ ਮੈਂ ਸਪੈਸੀਫਿਕੇਸ਼ਨ ਜੋ ਉਸ ਪ੍ਰੋਡਕਟ ਬਾਰੇ ਆਨਲਾਈਨ ਦੇਖਿਆ ਸੀ ਉਹੀ ਓ ਮੈਂ ਉਸ ਪ੍ਰੋਡਕਟ ਨੂੰ ਰਿਸੀਵ ਕਰਨ ਤੋਂ ਬਾਅਦ ਉਸ ਵਿੱਚ ਸਭ ਉਹ ਕੁਆਲਿਟੀਸ ਸਨ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਫਲਿਪਕਾਰਟ ਤੋਂ ਉਹਨਾਂ ਨੇ ਕਾਫੀ ਆਫਰ ਦਿੱਤੇ ਵੀ ਤੁਹਾਡਾ ਫਸਟ ਪ੍ਰੋਡਕਟ ਤੁਸੀਂ ਸਾਡੇ ਇਸ ਵੈਬਸਾਈਟ ਤੋਂ ਕੀਤਾ ਸੀ ਨੈਕਸਟ ਪ੍ਰੋਡਕਟ ਵੀ ਤੁਸੀਂ ਸਾਡੇ ਤੋਂ ਪਰਚੇਜ ਕਰ ਸਕਦੇ ਹੋ ਤਾਂ ਜੋ ਕਿ ਆਪਣੀ ਵੈਬਸਾਈਟ ਹੈ ਫਲਿੱਪਕਾਰਡ ਫਲਿੱਪਕਾਰਟ ਐਪ ਹੈ ਜੋ ਮੋਬਾਇਲਾਂ ਦੇ ਉੱਪਰ ਉਹਨਾਂ ਦੀ ਬੜੀ ਉਹਨਾਂ ਦਾ ਥੈਂਕਸ ਕਰਦਾ ਕਿ ਬਹੁਤ ਅੱਛੀ ਸਰਵਿਸ ਹੈ ਜੋ ਸਾਰੇ ਇੰਡੀਆ ਨੂੰ ਸਾਰੇ ਦੁਨੀਆਂ ਨੂੰ ਜਿੱਥੇ ਜਿੱਥੇ ਵੀ ਉਹਨਾਂ ਦੀ ਉਹ ਐਪ ਕੰਮ ਕਰਦੀ ਹੈ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਤਾਂ ਬਹੁਤ ਅੱਛਾ ਉਹਨਾਂ ਦਾ ਕੰਮ ਹੈ ਅਤੇ ਬਹੁਤ ਜੋ ਮੇਰਾ ਐਕਸਪੀਰੀਅਂਸ ਰਿਹਾ ਫਸਟ ਪ੍ਰੋਡਕਟ ਜੋ ਮੈਂ ਆਨਲਾਈਨ ਕੀਤਾ ਸੀ ਬਹੁਤ ਵਧੀਆ ਰਿਹਾ ਅਤੇ ਉਸ ਤੋਂ ਬਾਅਦ ਵੀ ਮੈਂ ਜੋ ਪ੍ਰੋਡਕਟ ਖਰੀਦੇ ਸੀ ਥਰੂ ਫਲਿੱਪਕਾਰਟ ਉਹ ਵੀ ਬਹੁਤ ਵਧੀਆ ਰਿਹਾ ਮੇਰਾ ਐਕਸਪੀਰੀਅਂਸ ਉਹਨਾਂ ਨੂੰ ਲੈ ਕੇ ਵੀ ਅਤੇ ਬਹੁਤ ਅੱਛਾ ਲੱਗਦਾ ਜਦੋਂ ਆਪਾਂ ਕੋਈ ਪ੍ਰੋਡਕਟ ਔਨਲਾਈਨ ਖਰੀਦਦੇ ਹਾਂ ਤਾਂ ਉਹ ਪ੍ਰੋਡਕਟ ਉਸ ਕੰਡੀਸ਼ਨ 'ਚ ਆਉਣਾ ਜਦੀ ਜਿਹੜੀ ਕੰਡੀਸ਼ਨ ਅਸੀਂ ਆਨਲਾਈਨ ਦੇਖਦੇ ਹਾਂ ਹੈ ਨਾ ਬਟ ਮੇਰੇ ਮਿੱਤਰ ਜੋ ਕਈ ਵਾਰ ਆਨਲਾਈਨ ਆਰਡਰ ਕਰ ਦਿੰਦੇ ਆ ਲੇਕਿਨ ਕਈ ਵਾਰ ਉਹਨਾਂ ਦਾ ਸਾਈਜ਼ ਘੱਟ ਆ ਗਿਆ ਵੱਧ ਆ ਗਿਆ ਕਲਰ ਹੋਰ ਆ ਗਿਆ ਬ੍ਰਾਂਡ ਹੋਰ ਆ ਗਿਆ ਨਾ ਅਤੇ ਇਸ ਤਰ੍ਹਾਂ ਦੀ ਜੋ ਹੈ ਪ੍ਰੋਬਲਮਸ ਆਉਂਦੀਆਂ ਲੇਕਿਨ ਮੈਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਜਿਸ ਕਰਕੇ ਮੈਂ ਹੈਨਾ ਬੜਾ ਉਹਨਾਂ ਦਾ ਥੈਂਕਸ ਕਰਦਾਂ ਅਤੇ ਇੱਕ ਹੋਰ ਜੋ ਹੈ ਕਿ ਟਾਈਮ ਜੋ ਕੰਜਊਮਿੰਗ ਹੈ ਜੋ ਟਾਈਮ ਦੀ ਸਮੇਂ ਦੀ ਦੁਰਵਰਤੋਂ ਜਦੋਂ ਆਪਾਂ ਕਿਸੇ ਸ਼ੋਪ 'ਤੇ ਜਾਂਦੇ ਹਾਂ ਹੈ ਨਾ ਤਾਂ ਉਹ ਸਾਨੂੰ ਆਨਲਾਈਨ ਘਰ ਬੈਠਿਆਂ ਨੂੰ ਸਾਰਾ ਕੁਝ ਉਪਲਬਧ ਕਰਵਾਉਂਦੇ ਅਤੇ ਇਟ ਮੀਨਸ ਬਹੁਤ ਗੁਡ ਇਨੀਸ਼ੀਟਿਵ ਹੈ ਬਹੁਤ ਅੱਛੇ ਉਹਨਾਂ ਦੇ ਜੋ ਹੈ ਸ਼ੁਰੂਆਤ ਉਹਨਾਂ ਦੀ ਤਾਂ ਬਹੁਤ ਬਹੁਤ ਧੰਨਵਾਦ ਜੀ